ਅੱਜ ਕੱਲ੍ਹ ਬੈਂਕਿੰਗ ਨੂੰ ਸੌਖਾ ਬਣਾਉਣ ਲਈ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਬਣਾ ਲਈਆਂ ਹਨ ਪਹਿਲਾਂ ਅੱਜ ਤੋਂ ਪਹਿਲਾਂ ਬੈਂਕਿੰਗ ਦੀ ਸੇਵਾ ਲੈਣ ਲਈ ਬੰਦੇ ਨੂੰ ਥੋੜ੍ਹੇ ਪੈਸੇ ਕਾਊਂਟ ਵਿੱਚ ਰੱਖਣੇ ਪੈਂਦੇ ਸਨ ਪਰ ਹੁਣ ਅੱਜ ਕੱਲ੍ਹ ਸਰਕਾਰ ਦੀ ਬਣਾਈ ਯੋਜਨਾ ਮੇਰਾ ਖਾਤਾ ਭਾਗਯ ਵਿਧਾਤਾ ਐਂਡ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵਿੱਚੋਂ ਲੋਕਾਂ ਦੇ ਜ਼ੀਰੋ ਬੈਲੈਂਸ ਅਕਾਊਂਟ ਖੋਲ੍ਹੇ ਜਾਂਦੇ ਹਨ ਜਿਸ ਵਿੱਚ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਦੇਣਾ ਪੈਂਦਾ ਅਕਾਊਂਟ ਖੁਲ੍ਹਾਉਣ ਲਈ ਅਤੇ ਉਸਦੇ ਨਾਲ ਨਾਲ ਉਹਨਾਂ ਨੂੰ ਫਰੀ ਏ ਟੀ ਐਮ ਦੀ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਨਾਲ ਉਹ ਆਪਣੇ ਪੈਸੇ ਕਢਾ ਲੈਂਦੇ ਹਨ ਤੇ ਜਮ੍ਹਾਂ ਕਰਵਾ ਸਕਦੇ ਹਨ ਅਤੇ ਇਹਨਾਂ ਪੈਸੇ ਜਮ੍ਹਾਂ ਕਰਵਾਉਣ ਅਤੇ ਕਢਾਉਣ ਲਈ ਉਹਨਾਂ ਨੂੰ ਕੋਈ ਵੀ ਵੱਧ ਪੈਸੇ ਨਹੀਂ ਦੇਣੇ ਪੈਂਦੇ ਹਨ ਇਹ ਖਾਤਾ ਸਰਕਾਰ ਦੀ ਯੋਜਨਾ ਦੇ ਨਾਲ ਹੀ ਦਿੱਤਾ ਜਾਂਦਾ ਹੈ ਅਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਇੰਸ਼ੋਰੈਂਸ ਦੀ ਵੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਇਸ ਦੇ ਨਾਲ ਧੰਨਵਾਦ